ਸਤਿ ਸ਼੍ਰੀ ਅਕਾਲ ਜੀ ਜਿੱਦਾਂ ਕਿ ਅਸੀਂ ਵੇਖਦੇ ਹਾਂ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਆ ਅਤੇ ਇਹ ਧਰਤੀ ਬਹੁਤ ਪਵਿੱਤਰ ਮੰਨੀ ਜਾਂਦੀ ਆ ਇੱਥੇ ਆਏ ਦਿਨ ਕੋਈ ਨਾ ਕੋਈ ਸੈਲਾਨੀ ਆਉਂਦੇ ਰਹਿੰਦੇ ਆ ਘੁੰਮਣ ਫਿਰਨ ਨੂੰ ਟੂਰਿਸਟ ਬਹੁਤ ਆਉਂਦੇ ਆ ਜਦੋਂ ਟੂਰਿਸਟ ਆਉਂਦੇ ਆ ਤਾਂ ਮੈਂ ਚਾਹੁੰਦੀ ਕਿ ਸਾਡਾ ਜਿਹੜਾ ਇੱਕ ਨਜ਼ਰੀਆ ਹੈ ਨਾ ਉਹਨਾਂ ਦੀ ਸਾਡੀ ਜਿਹੜੀ ਇਮੇਜ ਆ ਉਹਨਾਂ ਦੀ ਨਜ਼ਰ 'ਚ ਵਧੀਆ ਬਣੇ ਕਿ ਨਹੀਂ ਪੰਜਾਬ ਤੋਂ ਵਧੀਆ ਕੋਈ ਸਿਟੀ ਹੈ ਨਹੀਂ ਇਸ ਵਾਸਤੇ ਮੈਂ ਚਾਹੁੰਦੀ ਕਿ ਜਿਹੜਾ ਮੇਰਾ ਇਲਾਕਾ ਆ ਜਿੱਥੇ ਮੈਂ ਰਹਿ ਰਹੀ ਹਾਂ ਉਹ ਸਾਫ ਸੁਥਰਾ ਖੂਬਸੂਰਤ ਲੱਗੇ ਇਸ ਕਰਕੇ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਹਾਂ ਜੇ ਮੈਨੂੰ ਰਸਤੇ 'ਚ ਕੁਝ ਵੀ ਕਚਰਾ ਫੈਲਿਆ ਦਿਖਦਾ ਆ ਤਾਂ ਮੈਂ ਉਹਨੂੰ ਚੁੱਕਦੀ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਸਾਫ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਮੈਂ ਮੇਰਾ ਮੰਨਣਾ ਹੈ ਕਿ ਅਗਰ ਮੈਂ ਸ਼ੁਰੂਆਤ ਕੀਤੀ ਇੱਕ ਸ਼ੁਰੂਆਤ ਇੱਕ ਸ਼ੁਰੂਆਤ ਦੇ ਨਾਲ ਹੀ ਇੱਕ ਕਦਮ ਦੇ ਨਾਲ ਹਜ਼ਾਰੋਂ ਕਦਮ ਉੱਠਦੇ ਆ ਅਤੇ ਫਿਰ ਇਸ ਕਰਕੇ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹਾਂ ਮੈਂ ਲੋਕਾਂ ਨੂੰ ਪ੍ਰਭਾਵਿਤ ਵੀ ਕਰਦੀ ਹਾਂ ਕਿ ਤੁਸੀਂ ਸਫਾਈ ਰੱਖੋ ਮੈਂ ਜੇ ਕਿਸੇ ਨੂੰ ਕਚਰਾ ਫੈਲਾਉਂਦਾ ਦੇਖਦੀ ਹਾਂ ਤਾਂ ਮੈਂ ਉਹਨਾਂ ਨੂੰ ਸਮਝਾਉਂਦੀ ਹਾਂ ਕਿ ਇੱਦਾਂ ਨਾ ਕਰੋ ਥੋੜ੍ਹੀ ਸਾਫ ਸਫਾਈ ਰੱਖੋ ਜੇ ਮੇਰਾ ਸ਼ਹਿਰ ਮੇਰਾ ਘਰ ਸੋਹਣਾ ਹੋ ਸਕਦਾ ਆ ਤਾਂ ਫਿਰ ਆਪਾਂ ਬਾਹਰ ਜਾ ਕੇ ਕਿਤੇ ਹੋਰ ਕਿਉਂ ਗੰਦ ਫੈਲਾਈਏ ਮੈਂ ਲੋਕਾਂ ਨੂੰ ਸਮਝਾਉਂਦੀ ਹਾਂ ਕਿ ਅਗਰ ਆਪਾਂ ਆਪਣਾ ਕਮਰਾ ਸਾਫ ਸੁਥਰਾ ਰੱਖ ਸਕਦੇ ਹਾਂ ਆਪਣਾ ਘਰ ਸਾਫ ਸੁਥਰਾ ਰੱਖ ਸਕਦੇ ਹਾਂ ਅਤੇ ਜਿਸ ਸ਼ਹਿਰ 'ਚ ਆਪਾਂ ਰਹੇ ਹਾਂ ਜੰਮੇ ਹਾਂ ਪਲੇ ਹਾਂ ਉਹਨੂੰ ਸਾਫ ਕਿਉਂ ਨਹੀਂ ਰੱਖ ਸਕਦੇ ਜੇ ਮੈਂ ਦੇਖਦੀ ਹਾਂ ਕਿ ਕੋਈ ਕੁਛ ਸਾੜਦਾ ਪਿਆ ਵਾ ਪੋਲੀਥੀਨ ਵਗੈਰਾ ਸਾੜਦੇ ਪਏ ਆ ਮੋਮੀ ਲਿਫਾਫੇ ਤਾਂ ਮੈਂ ਉਹਨਾਂ ਨੂੰ ਟੋਕਦੀ ਹਾਂ ਮੈਂ ਉਹਨਾਂ ਨੂੰ ਸਮਝਾਉਂਦੀ ਹਾਂ ਉਹਨਾਂ ਨੂੰ ਦੱਸਦੀ ਹਾਂ ਕੁਝ ਲੋਕਾਂ ਨੂੰ ਨਹੀਂ ਪਤਾ ਹੁੰਦਾ ਕੁਝ ਲੋਕ ਤਾਂ ਬਹੁਤ ਜਲਦੀ ਮੰਨ ਜਾਂਦੇ ਗੱਲ ਨੂੰ ਕਿ ਹਾਂਜੀ ਅਸੀਂ ਸਹਿਮਤ ਹਾਂ ਕੁਛ ਲੋਕ ਜਿਹੜੇ ਨਹੀਂ ਜਾਣਦੇ ਇਹਨਾਂ ਗੱਲਾਂ ਨੂੰ ਜਦੋਂ ਜਾਣਦੇ ਆ ਉਹ ਫਿਰ ਸੰਭਲ ਜਾਂਦੇ ਆ ਉਹ ਨਹੀਂ ਸਾੜਦੇ ਪਰ ਕੁਛ ਲੋਕ ਉਲਟਾ ਬਹਿਸ ਬਾਜ਼ੀ ਕਰਦੇ ਆ ਪਰ ਫਿਰ ਵੀ ਮੈਂ ਉਹਨਾਂ ਦੀ ਬਹਿਸ ਬਾਜ਼ੀ ਨੂੰ ਨਹੀਂ ਦੇਖਦੀ ਮੈਂ ਉਹਨਾਂ ਨੂੰ ਵੀ ਬਹਿਸ ਬਾਜ਼ੀ ਨੂੰ ਇਗਨੋਰ ਕਰਦੀ ਹਾਂ ਮੈਂ ਕਹਿੰਦੀ ਨਹੀਂ ਕੋਈ ਨਹੀਂ ਹੁਣ ਜੋ ਵੀ ਹੈ ਹੁੰਦਾ ਆ ਹੁਣ ਚਲੋ ਚਾਰ ਜਣਿਆਂ ਵਿੱਚੋਂ ਕੋਈ ਇੱਕ ਅੱਧਾ ਤਾਂ ਮੈਨੂੰ ਸਮਝਦਾਰ ਮਿਲੇਗਾ ਨਾ ਜਿਹੜਾ ਮੇਰੀ ਗੱਲ ਨੂੰ ਸਮਝੇਗਾ ਆਪਣੇ ਸ਼ਹਿਰ ਨੂੰ ਆਪਣੇ ਘਰ ਨੂੰ ਆਪਣੀ ਸਿਟੀ ਨੂੰ ਸੰਭਾਲੇਗਾ ਆਪਣਾ ਜਿਹੜਾ ਸ਼ਹਿਰ ਆ ਆਪਣਾ ਜਿਹੜਾ ਘਰ ਆ ਸਾਰੇ ਸਾਡੇ ਦੋਸਤ ਆ ਮਿੱਤਰ ਆ ਸਭ ਸਾਡਾ ਆ ਅਸੀਂ ਆਪਣੇ ਘਰ ਨੂੰ ਨਹੀਂ ਸਾਂਭਾਂਗੇ ਤਾਂ ਫਿਰ ਕੌਣ ਸਾਂਭੇਗਾ ਇਸ ਕਰਕੇ ਮੈਂ ਆਪਣਾ ਸ਼ਹਿਰ ਨੂੰ ਸਾਂਭਣ 'ਚ ਪੂਰਾ ਪੂਰਾ ਮ ਮੇਰਾ ਪੂਰਾ ਪੂਰਾ ਸਾਥ ਮੇਰਾ ਪੂਰਾ ਪੂਰਾ ਜਿਹੜਾ ਆ ਕੋਸ਼ਿਸ਼ ਕਰਦੀ ਹਾਂ ਕਿ ਮੈਂ ਉਹਨੂੰ ਸਾਂਭਾ ਆਪਣੇ ਸ਼ਹਿਰ ਨੂੰ ਧੰਨਵਾਦ ਜੀ